ਹੈਲੋ ਹੈਲੋ ਹਾਂਜੀ ਹੈਲੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸਤਿ ਸ਼੍ਰੀ ਅਕਾਲ ਜੀ ਹੋਰ ਜੱਥੇਦਾਰ ਜੀ ਠੀਕ ਠਾਕ ਹੋ ਬਸ ਵਧੀਆ ਜੀ ਇਹ ਬੜੀ ਆਪਣੇ ਗੁਰੂ ਮਹਾਰਾਜ ਦੀ ਕਿਰਪਾ ਹੋਈ ਤਾਂ ਇੱਕ ਆਪਾਂ ਪ੍ਰੋਗਰਾਮ ਬਣਾਇਆ ਸੀ ਵੀ ਆਪਾਂ ਨਾ ਮਹੀਨੇ ਦੀ ਆਉਂਦੀ ਹੋਈ ਤੀਹ ਤਰੀਕ ਨੂੰ ਨਾ ਆਪਾਂ ਇੱਥੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆ ਰਹੇ ਸੀ ਅਤੇ ਫੈਮਲੀ ਆਪਣੇ ਨਾਲ ਹੈਗੀ ਅਤੇ ਉਹਦਾ ਮੈਂ ਪੁੱਛਿਆ ਸੀ ਮੈਂ ਕਿਹਾ ਚਲੋ ਭਾਈ ਸਾਹਿਬ ਨਾਲ ਗੱਲ ਕਰ ਲਈਏ ਤਾਂ ਮੈਨੂੰ ਦੱਸ ਦਿਓ ਵੀ ਆਪਣੇ ਰੂਮਸ ਵਗੈਰਾ ਮਤਲਬ ਕਿਵੇਂ ਹੈ ਏ ਸੀ ਅਤੇ ਨੋਨ ਏ ਸੀ ਦੋਵੇਂ ਹੁੰਦੇ ਆ ਕਿ ਹੁਣ ਨੂੰ ਪਤਾ ਅੱਛਾ ਅੱਛਾ ਅਤੇ ਮੈਨੂੰ ਦੱਸਿਓ ਮਾੜਾ ਜਿਹਾ ਵੀ ਆਪਾਂ ਫਿਰ ਕਿੱਦਾਂ ਮਤਲਬ ਕੀ ਸਿਸਟਮ ਬਣੂ ਅ ਕਿੰਨੇ ਕੁ ਵਜੇ ਆਈਏ ਅਤੇ ਅੱਛਾ ਠੀਕ ਹੈ ਅੱਛਾ ਅੱਛਾ ਅੱਛਾ ਅੱਛਾ ਤੇ ਅੰਦਰ ਮਤਲਬ ਫਿਰ ਵਾਸ਼ਰੂਮ ਵਗੈਰਾ ਵਧੀਆ ਅੱਛਾ ਠੀਕ ਆ ਅਤੇ ਪਹਿਲਾਂ ਫਿਰ ਮਤਲਬ ਸ਼ਾਮ ਨੂੰ ਇੱਥੇ ਆ ਜਾਂਗੇ ਹੈ ਨਾ ਤਾਂ ਉਦੋਂ ਸਵੇਰੇ ਫਿਰ ਦਰਸ਼ਨ ਕਰ ਲਾਂਗੇ ਹੈ ਨਾ ਦਰਬਾਰ ਸਾਹਿਬ ਦੇ ਅਤੇ ਹੋਰ ਨੇੜੇ ਫਿਰ ਕਿਹੜੇ ਕਿਹੜੇ ਗੁਰਦੁਆਰੇ ਹੈਗੇ ਆ ਜੀ ਅੱਛਾ ਅੱਛਾ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਆ ਠੀਕ ਹੈ ਠੀ ਅੱਛਾ ਅੱਛਾ ਅੱਛਾ ਅੱਛਾ ਇੱਥੇ ਮੈਂ ਸੁਣਿਆ ਬਾਬਾ ਬਾਬਾ ਦੀਪ ਸਿਆਂ ਬਾਬਾ ਦੀਪ ਸਿੰਘ ਜੀ ਦਾ ਭੋਰਾ ਵੀ ਹੈਗਾ ਹਨਾ ਵੀ ਭੋਰਾ ਸਾਹਿਬ ਭੋਰਾ ਸਾਹਿਬ ਹੈਗਾ ਹੈ ਨਾ ਅੱਛਾ ਅੱਛਾ ਅੱਛਾ ਅੱਛਾ ਅੱਛਾ ਅੱਛਾ ਠੀਕ ਹੈ ਅਤੇ ਚੱਲੇ ਹੋ ਚੱਲੋਗੇ ਫਿਰ ਸਰ ਤੁਸੀਂ ਵੀ ਨਾਲ ਹੀ ਅੱਛਾ ਅੱਛਾ ਤਾਂ ਫਿਰ ਮੈਨੂੰ ਐਂ ਦੱਸੋ ਆਪਣਾ ਜਿਹੜਾ ਲਾਗੇ ਸ਼ਹਿਰ ਪੈਂਦਾ ਇੱਥੋਂ ਮਤਲਬ ਬੱਸਾਂ ਚੱਲਦੀਆਂ ਜਾਂ ਟ੍ਰੇਨ 'ਤੇ ਆਈਏ ਜਾਂ ਕਿੱਦਾਂ ਕੋਈ ਟੈਕਸੀ ਲੈਣੀ ਪਊਗੀ ਅੱਛਾ ਅੱਛਾ ਅੱਛਾ ਅਤੇ ਉਹਦਾ ਫਿਰ ਮੈਨੂੰ ਦੱਸ ਦਿਓ ਜੀ ਕੀ ਬਿੱਲ ਵਗੈਰਾ ਹੈਗਾ ਗਾ ਅੱਛਾ ਅਤੇ ਆਸੇ ਪਾਸੇ ਘੁੰਮਣ ਵਾਲੀਆਂ ਹੋਰ ਵੀ ਜਗ੍ਹਾ ਹੈਗੀਆਂ ਮੈਂ ਸੁਣਿਆ ਇੱਥੇ ਅੱਛਾ ਅੱਛਾ ਅੱਛਾ ਚਲੋ ਠੀਕ ਆ ਭਾਈ ਸਾਹਿਬ ਹੈ ਨਾ ਮਤਲਬ ਸੌਖਾ ਹੋ ਜਾਂਦਾ ਹੈ ਨਾ ਤੁਹਾਡਾ ਵੀ ਤੁਸੀਂ ਨਾਲ ਹੈਗੇ ਹੋ ਹੈ ਨਾ ਚਲੋ ਇਕੱਠੇ ਰਹੇ ਵਏ ਹਾਂ ਉੱਥੇ ਉੱਥੇ ਤੁਸੀਂ ਅ ਹਿਮਾਚਲ 'ਚ ਹੈ ਨਾ ਜਦੋਂ ਟ੍ਰੇਨਿੰਗ ਲੱਗੀ ਵੀ ਸੀ ਬੜਾ ਟਾਈਮ ਨਾਲ ਰਹੇ ਹਾਂ ਹੈ ਨਾ ਤਾਂ ਮੈਂ ਕਿਹਾ ਚਲੋ ਭਾਈ ਸਾ ਬਿਲਕੁਲ ਜੀ ਬਿਲਕੁਲ ਬੱਚਿਆਂ ਨੂੰ ਸੱਭਿਆਚਾਰ ਬਾਰੇ ਆਪਣੇ ਪਿਛੋਕੜ ਬਾਰੇ ਪਤਾ ਲੱਗਦਾ ਕਿਉਂ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹੂੰ ਹੂੰ ਬਿਲਕੁਲ ਬਿਲਕੁਲ ਹਾਂ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਪਹਿਲਾਂ ਮੇਰੀ ਇੱਧਰ ਡਿਊਟੀ ਲੱਗੀ ਹੋਈ ਸੀ ਅਤੇ ਔਫਿਸ 'ਚ ਹੁੰਦੇ ਸੀ ਤਾਂ ਉੱਧਰ ਟਾਈਮ ਨਹੀਂ ਲੱਗਿਆ ਡਿਪਟੀ ਸਾਹਿਬ ਨਾਲ ਹੈਗੀ ਸੀ ਮੁਲਾਕਾਤ ਹਾਂ ਹਾਂਜੀ ਹਾਂਜੀ ਬਸ ਹੁਣ ਫਰੀ ਹੋਏ ਸੀ ਮੈਂ ਕਿਹਾ ਚਲੋ ਭਾਈ ਸਾਹਿਬ ਨਾਲ ਕਾਲ ਕਰਦੇ ਹਾਂ ਗੇ ਪੁੱਛਦੇ ਹਾਂ ਆਪਾਂ ਚਲੋ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਓਕੇ